ਪੰਜ ਜੁਲਾਈ ਦੋ ਹਜ਼ਾਰ ਪੰਜ ਛੇ ਜੂਨ ਦੋ ਹਜ਼ਾਰ ਇੱਕ ਅੱਠ ਜਨਵਰੀ ਦੋ ਹਜ਼ਾਰ ਦੋ ਚੌਵੀ ਅਕਤੂਬਰ ਦੋ ਹਜ਼ਾਰ ਇੱਕ ਪੱਚੀ ਅਕਤੂਬਰ ਦੋ ਹਜ਼ਾਰ ਦਸ